ਕੁਝ ਚਿਰ ਪਹਿਲਾਂ ਦੀ ਹੀ ਗੱਲ ਹੈ ਕਿ ਮੇਰਾ ਵੱਡਾ ਭਰਾ ਅਮੈਰੀਕਾ ਤੋਂ ਹੀ ਲੋਟਿਆ ਸੀ ਪਰ ਉਹ ਛੋਟੀ ਉਮਰ ਵਿੱਚ ਹੀ ਚਲਾ ਗਿਆ ਸੀ ਤਾਂ ਓਹਨੂੰ ਪੰਜਾਬ ਦੇ ਵਿਰਸੇ ਬਾਰੇ ਇੰਨਾਂ ਨਹੀਂ ਸੀ ਪਤਾ ਕਿਉਂਕਿ ਉਹ ਤਾਂ ਹਰਿਆਣਾ ਵਿੱਚ ਰਹਿੰਦੇ ਸਨ ਤਾਂ ਹਰਿਆਣੇ ਵਾਲਿਆਂ ਨੂੰ ਤਾਂ ਕਿੱਥੇ ਹੀ ਪਤਾ ਹੋਣਾ ਸੀ ਫਿਰ ਜਦੋਂ ਉਹ ਪੰਜਾਬ ਪਰਤਿਆ ਤਾਂ ਮੈਂ ਓਹਨੂੰ ਕਿਹਾ ਵੀ ਚੱਲ ਅੱਜ ਮੈਂ ਤੁਹਾਨੂੰ ਆਪਣਾ ਵਿਰਸਾ ਘੁੰਮਾਂ ਕੇ ਲਿਆਉਂਦੀ ਹਾਂ ਤਾਂ ਓਹ ਬਹੁਤ ਖੁਸ਼ ਸੀ ਮੈਂ ਓਹਨੂੰ ਦੱਸਿਆ ਕਿ ਇਹ ਪੰਜਾਬ ਦਾ ਵਿਰਸਾ ਹੈ ਮੈਂ ਓਹਨੂੰ ਫਤਿਹਗੜ੍ਹ ਸਾਹਿਬ ਘੁੰਮਾਇਆ ਸਰਹੰਦ ਦੀ ਗੜੀ ਦਿਖਾਈ ਉਹਨੂੰ ਪੰਜਾਬ ਦੀ ਜਿਹੜੀ ਵੀ ਮੁੱਖ ਮੁੱਖ ਥਾਵਾਂ ਸੀ ਉਹ ਸਾਰੀਆਂ ਦਿਖਾਈਆ ਓਹਨੂੰ ਅਨੰਦਪੁਰ ਸਾਹਿਬ ਲੈ ਕੇ ਗਈ ਪਟਿਆਲੇ ਦੇ ਰਾਜੇ ਦੇ ਕਿਲ੍ਹੇ ਵਿੱਚ ਲੈ ਕੇ ਗਈ ਓਹ ਪਟਿਆਲੇ ਦੀ ਕਾਲੀ ਮਾਤਾ ਦਾ ਪ੍ਰਸਿੱਧ ਮੰਦਿਰ ਦਿਖਾਇਆ ਜਿਸ ਮਾਤਾ ਨੂੰ ਰਾਜਾ ਕਲਕੱਤੇ ਤੋਂ ਜਾ ਕੇ ਲੈ ਕੇ ਆਇਆ ਸੀ ਅਤੇ ਉਹ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਓਹਨੂੰ ਇਹ ਮੈਨੂੰ ਇਹ ਚੀਜ਼ ਦਾ ਬਹੁਤ ਅਨੁਭਵ ਹੋਇਆ ਕਿ ਮੈਂ ਆਪਣੇ ਪੰਜਾਬ ਬਾਰੇ ਕਿਸੇ ਨੂੰ ਦੱਸ ਸਕੀ ਹਾਂ ਕਿਉਂਕਿ ਸਾਡੇ ਪੰਜਾਬ ਵਿੱਚ ਬਹੁਤ ਕੁਛ ਇੱਦਾਂ ਦਾ ਹੈ ਜੋ ਕਿ ਲੋਕਾਂ ਨੂੰ ਹਲੇ ਤੱਕ ਨਹੀਂ ਪਤਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਕਿਸੇ ਨੂੰ ਆਪਣੇ ਪੰਜਾਬ ਦੀ ਵਿਰਸਾ ਅਤੇ ਚਾਨਣਾ ਪਾ ਸਕੀ ਹਾਂ ਤਾਂ ਇਹ ਮੇਰਾ ਅਨੁਭਵ ਬਹੁਤ ਹੀ ਵਧੀਆ ਰਿਹਾ ਤਾਂ ਓਹਨੂੰ ਵੀ ਬਹੁਤ ਵਧੀਆ ਲੱਗਿਆ ਪੰਜਾਬ ਘੁੰਮ ਕੇ